ਉੱਤਰੀ ਭਾਰਤੀ ਖਾਣਾ ਜਿਵੇਂ ਕਿ ਚੌਲ ਹੋ ਗਿਆ ਕਣਕ ਦਾ ਆਟਾ ਹੋ ਗਿਆ ਤੂੜਾ ਹੋ ਗਿਆ ਮੂੰਗੀ ਤੂਵਰ ਲੋਵੀਆ ਜਿੱਦਾਂ ਕਿ ਆਲੂ ਚਾਟ ਮੈਨੂੰ ਖਾਣਾ ਵੀ ਬਹੁਤ ਪਸੰਦ ਆ ਅਤੇ ਬਣਾਉਣਾ ਵੀ ਬੜਾ ਪਸੰਦ ਆ ਕੋਰਮਾ ਹੋ ਗਿਆ ਕਬਾਬ ਹੋ ਗਿਆ ਲਾਰੀ ਕੁਲਚਾ ਵੀ ਬਹੁਤ ਵਧੀਆ ਲੱਗਦਾ ਅਤੇ ਮੈਂ ਇੱਕ ਵਾਰੀ ਟੇਸਟ ਵੀ ਕੀਤਾ ਸੀ ਆਲੂ ਚਾਟ ਬਣਾ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ ਖਾਣ 'ਚ ਵੀ ਬੜਾ ਟੇਸਟ ਲੱਗਦਾ ਹੈ ਅਤੇ ਬਣਾਉਣ 'ਚ ਵੀ ਬੜਾ ਵਧੀਆ ਲੱਗਦਾ ਹੈ ਇੱਕ ਵਾਰ ਸੈਰ 'ਤੇ ਗਏ ਸੀ ਅੰਮ੍ਰਿਤਸਰ ਉੱਥੋਂ ਮੈਂ ਖਾ ਕੇ ਦੇਖਿਆ ਸੀ ਬਹੁਤ ਵਧੀਆ ਲੱਗਾ ਅਤੇ ਜਿਸ ਤਰ੍ਹਾਂ ਕਿ ਦੱਖਣੀ ਖਾਣਾ ਹੋ ਗਿਆ ਡੋਸਾ ਹੋ ਗਿਆ ਸਾਂਬਰ ਹੋ ਗਿਆ ਸਾਂਬਰ ਇਡਲੀ ਹੋ ਗਿਆ ਇਹ ਜਿੱਦਾਂ ਕਿ ਚੌਲ ਤਾਂ ਹਰ ਕੋਈ ਹਰ ਕੋਈ ਡਿਸ਼ 'ਚ ਖਾਣਾ ਪਸੰਦ ਕਰਦਾ ਹੈ ਇਹ ਡਿਸ਼ਿਸ ਮੈਨੂੰ ਬਹੁਤ ਹੀ ਵਧੀਆ ਲੱਗੀ